ਹੈਲੋ ਜੀ ਮੈਂ ਕਿਹਾ ਜੀ ਤੁਸੀਂ ਅਮਨ ਟਰੈਵਲਿੰਗ ਤੋਂ ਬੋਲ ਰਹੇ ਹੋ ਜੀ ਮੇਰਾ ਨਾਮ ਮਨੀ ਹੈ ਜੀ ਮੈਂ ਰੈਲ ਮਾਜਰੇ ਤੋਂ ਬੋਲ ਰਹਾ ਰਿਹਾ ਹਾਂ ਜੀ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਜੀ ਵੀ ਮੈਂ ਪਰਸੋਂ ਕੱਲ੍ਹ ਕੈਬ ਕੈਂਸਲ ਕੀਤੀ ਸੀਗੀ ਜੀ ਉਹ ਪੰਜ ਸੌ ਪੰਜ ਸੌ ਰੁਪਿਆ ਰਿਫੰਡ ਹਾਲੇ ਤੱਕ ਸਾਡੇ ਖਾਤੇ ਵਿੱਚ ਨਹੀਂ ਆਏ ਆ ਜੀ ਮੈਂ ਇਸ ਬਾਰੇ ਪੁੱਛਣਾ ਚਾਹੁੰਦਾ ਹਾਂ ਜੀ ਮੈਨੂੰ ਘਰ ਵਿੱਚ ਇੱਕ ਜ਼ਰੂਰੀ ਕੰਮ ਪੈ ਗਿਆ ਜੀ ਉਹ ਪੰਜ ਸੌ ਰੁਪਈਆ ਮੈਨੂੰ ਤੁਸੀਂ ਭੇਜ ਦਿਓ ਜੀ ਜਿਸ ਨੰਬਰ 'ਤੇ ਮੈਂ ਪੇ ਕੀਤੇ ਸੀਗੇ ਜੀ ਉਸ ਨੰਬਰ 'ਤੇ ਮੈਨੂੰ ਵਾਪਸ ਕਰ ਦਿ ਸੈਂਡ ਕਰ ਦਿਓ ਜੀ ਉਹ ਪੰਜ ਸੌ ਰੁਪਈਆ ਮੇਰੇ ਹਲੀ ਤੱਕ ਬੈਂਕ ਅਕਾਊਂਟ ਵਿੱਚ ਨਹੀਂ ਆਏ ਹਨ ਜੀ ਗੂਗਲ ਪੇ ਵਿੱਚ ਨਹੀਂ ਆਏ ਹਨ ਜੇਕਰ ਉਹ ਪੰਜ ਸੌ ਰੁਪਈਆ ਤੁਸੀਂ ਮੈਨੂੰ ਭੇਜ ਸਕੋ ਤਾਂ ਭੇਜ ਦਿਓ ਜੀ ਹੁਣੀ ਮੈਨੂੰ ਘਰ ਵਿੱਚ ਕੁਛ ਬਹੁਤ ਜ਼ਰੂਰੀ ਕੰਮ ਪੈ ਗਿਆ ਏ ਜੀ ਠੀਕ ਹੈ ਜੀ ਇਸ ਲਈ ਜਿਸ ਨ ਇਸ ਲਈ ਜਿੱਥੇ ਵੀ ਮੈਨੂੰ ਕੋਈ ਕੰਮ ਪਿਆ ਤਾਂ ਮੈਂ ਤੁਹਾਡੀ ਹੀ ਕੈਫ ਦੁਬਾਰਾ ਤੋਂ ਹੀ ਤੁਹਾਡੇ ਵਾਲੀ ਹੀ ਕੈਫ ਬੁੱਕ ਕਰਵਾਊਂਗਾ ਜੀ ਅੱਗੇ ਤੋਂ ਜੀ ਇਸ ਕਰਕੇ ਮੈਨੂੰ ਮੇਰੇ ਪੰਜ ਸੌ ਰੁਪਈਆ ਸੈਂਡ ਕੀਤਾ ਜਾਵੇ ਜੀ ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ ਜੀ ਜੇਕਰ ਤੁਸੀਂ ਮੈਨੂੰ ਰਿਫੰਡ ਪੰਜ ਸੌ ਰੁਪਈਆ ਵਾਪਸ ਕਰ ਦਿਓ

ਜਦ ਕਦੇ ਵੀ ਮੈਨੂੰ ਲੋੜ ਪਈ ਤਾਂ ਮੈਂ ਤੁਹਾਡੀ ਹੀ ਕੈਫ ਬੁੱਕ ਕਰਵਾਵਾਂਗਾ ਜੀ